ਮੇਰਾ ਮੰਨਣਾ ਇਹ ਹੈ ਜੇ ਬੰਦਾ ਕੋਈ ਵੀ ਕੰਮ ਸ਼ੌਂਕ ਨਾਲ ਕਰੇ ਤਾਂ ਉਹਦੇ ਵਰਗੀ ਰੀਸ ਨਹੀਂ ਜੇ ਆਪਾਂ ਕਿਸੇ ਨੂੰ ਚਾਹੇ ਆਪਾਂ ਨੌਕਰੀ 'ਤੇ ਲੱਗੇ ਹਾਂ ਜਾਂ ਆਪਾਂ ਕਿਸੇ ਦੇ ਨਾਲ ਕੰਮ ਕਰਦੇ ਹਾਂ ਜੇ ਆਪਾਂ ਇੱਕ ਮਜਬੂਰੀ ਬਸ ਕੰਮ ਕਰ ਰਹੇ ਹਾਂ ਤਾਂ ਉਹ ਕਦੇ ਵੀ ਕੰਮ ਪੂਰਾ ਨਹੀਂ ਹੋਵੇਗਾ ਜਿਵੇਂ ਕਿ ਮੈਂ ਇੱਕ ਬਹੁਤ ਹੀ ਤਕੜੇ ਪੋਲੀਟੀਸ਼ੀਅਨ ਦੇ ਨਾਲ ਕੰਮ ਕਰਦਾ ਹਾਂ ਅਤੇ ਮੈਂ ਉਹਨਾਂ ਦਾ ਐਜ ਏ ਓ ਐਸ ਡੀ ਕੰਮ ਕਰਦਾ ਹਾਂ ਤਾਂ ਮੇਰੇ ਕੋਲ ਉਹਨਾਂ ਦਾ ਸ਼ੋਸ਼ਲ ਮੀਡੀਆ ਅਕਾਊਂਟ ਹੈ ਮੈਂ ਜੋ ਕਿ ਜਿੱਥੇ ਵੀ ਅਸੀਂ ਜਾਂਦੇ ਆ ਦਿਹਾੜੀ ਦੀ ਸਾਡੀ ਮੂਵਮੈਂਟ ਹੁੰਦੀ ਹੈ ਉਹ ਅਸੀਂ ਸ਼ੋਸ ਫੋਟੋ ਰਾਹੀਂ ਖਿੱਚ ਕੇ ਫੋਟੋਗ੍ਰਾਫੀ ਨਾਲ ਉਹਨਾਂ ਦੀ ਵੀਡੀਓ ਬਣਾ ਕੇ ਅਸੀਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਅਪਡੇਟ ਕਰਦੇ ਰਹਿੰਦੇ ਹਾਂ ਮੈਨੂੰ ਸ਼ੌਂਕ ਹੈ ਮੈਂ ਸ਼ੌਂਕ ਦੇ ਨਾਲ ਕੰਮ ਕਰਦਾ ਹਾਂ ਜਦੋਂ ਵੀ ਕੋਈ ਵੀ ਬੰਦਾ ਸ਼ੌਂਕ ਨਾਲ ਕੰਮ ਕਰਦਾ ਹੈ ਤਾਂ ਉਹ ਅੱਗੇ ਵਧੇਗਾ ਅਤੇ ਤਰੱਕੀ ਕਰੇਗਾ ਕਦੇ ਵੀ ਉਹਨੂੰ ਕਿਸੇ ਵੀ ਕਿਸਮ ਦੀ ਕਦੇ ਵੀ ਦਿੱਕਤ ਨਹੀਂ ਆਵੇਗੀ ਜਿਹੜਾ ਵੀ ਬੰਦੇ ਨੇ ਜ਼ਿੰਦਗੀ 'ਚ ਕੰਮ ਕਰਨਾ ਹੋਵੇ ਹਮੇਸ਼ਾਂ ਸ਼ੌਂਕ ਨਾਲ ਕਰਨਾ ਚਾਹੀਦਾ ਹੈ ਇੱਕ ਫੋਟੋਗ੍ਰਾਫਰੀ ਦਾ ਇਹੋ ਜਿਹਾ ਸ਼ੌਂਕ ਹੈ ਜੋ ਬਹੁਤ ਹੀ ਵਧੀਆ ਹੈ ਅਤੇ ਬੰਦੇ ਕੋਲ ਜੇ ਆਪਾਂ ਕੰਮ ਕਰਨਾ ਤਾਂ ਬਹੁਤ ਹੀ ਵਧੀਆ ਕੁਆਲਿਟੀ ਦਾ ਮੋਬਾਇਲ ਫੋਨ ਜਾਂ ਕੈਮਰਾ ਹੋਵੇ ਤਾਂ ਉਸ ਦੇ ਵਰਗੀ ਕੋਈ ਵੀ ਰੀਸ ਨਹੀਂ ਮੇਰੀ ਹਰੇਕ ਬੰਦੇ ਨੂੰ ਇਹੀ ਸਲਾਹ ਵਾ ਜੇ ਤੁਸੀਂ ਫੋਟੋਗ੍ਰਾਫਰੀ ਦਾ ਸ਼ੌਂਕ ਰੱਖਦੇ ਹੋ ਤਾਂ ਇੱਕ ਬਹੁਤ ਹੀ ਵਧੀਆ ਕੈਮਰਾ ਰੱਖਣਾ ਚਾਹੀਦਾ ਸਾਨੂੰ ਪਹਿਲਾਂ ਪਰਫੈਕਟ ਸਿੱਖਣਾ ਚਾਹੀਦਾ ਹੈ ਵੀ ਕਿਸ ਜਗ੍ਹਾ 'ਤੇ ਕਿਸ ਤਰ੍ਹਾਂ ਆਪਾਂ ਫੋਟੋਗ੍ਰਾਫੀ ਕਰਨੀ ਹੈ ਜਾਂ ਨਹੀਂ ਕਰਨੀ ਫੋਟੋਗ੍ਰਾਫਰੀ ਨੂੰ ਆਪਾਂ ਸ਼ੌਂਕ ਦੇ ਨਾਲ ਨਾਲ ਇੱਕ ਆਪਣੇ ਕਿੱਤੇ ਵੱਜੋਂ ਵੀ ਅਪਣਾ ਸਕਦੇ ਹਾਂ